ਪਠਾਨਕੋਟ ਜ਼ਿਲ੍ਹਾ ਗੁਰੂ ਨਾਨਕ ਦੇਵ ਜੀ ਦੁਆਰਾ ਇਸਟੈਬਲਿਸ਼ ਕੀਤਾ ਗਿਆ ਸੀ ਇਹ ਉਦੋਂ ਹੋਇਆ ਜਦੋਂ ਅਫਗਾਨਿਸਤਾਨ ਦੇ ਪਠਾਨ ਭਾਰਤ ਵਿੱਚ ਆਏ ਸਨ ਤਾਂ ਇਸ ਜਗ੍ਹਾ ਦਾ ਨਾਮ ਪਠਾਨਕੋਟ ਹੋਇਆ ਪਠਾਨਕੋਟ ਇੱਕ ਬਹੁਤ ਹੀ ਵੱਡਾ ਸ਼ਹਿਰ ਹੈ ਇਹ ਇਲਾਕਾ ਆਪਣੇ ਭਾਈਚਾਰੇ ਲਈ ਕਾਫੀ ਪ੍ਰਸਿੱਧ ਹੈ ਅਤੇ ਕਾਫੀ ਖਾਣ ਪੀਣ ਦੀਆਂ ਚੀਜ਼ਾਂ ਵੀ ਮਿਲਦੀਆਂ ਹਨ ਬਹੁਤ ਵਧੀਆ ਜਗ੍ਹਾ ਹੈ ਇੱਥੇ ਤੁਸੀਂ ਬਹੁਤ ਜ਼ਿਆਦਾ ਖਰੀਦਦਾਰੀ ਵੀ ਕਰ ਸਕਦੇ ਹੋ ਇੱਥੇ ਵੀ ਲੋਕ ਵੀ ਕਾਫੀ ਮਿਲਣਸਾਰ ਹਨ ਇੱਥੇ ਤੁਸੀਂ ਬਹੁਤ ਆਕੇ ਤੁਸੀਂ ਰਹਿ ਸਕਦੇ ਹੋ ਬਹੁਤ ਹੀ ਵਧੀਆ ਇੱਥੇ ਦਾ ਵਾਤਾਵਰਨ ਵੀ ਕਾਫੀ ਵਧੀਆ ਹੈ